ਹਾਂਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਾਈਫ ਪਾਰਟਨਰ ਨਾਲ਼ ਘੁੰਮਣਾ ਚਾਹੁੰਦੀ ਹਾਂ ਅਤੇ ਉਹ ਇਸ ਕਰਕੇ ਘੁੰਮਣਾ ਚਾਹੁੰਦੀ ਹਾਂ ਕਿ ਉਹ ਪਰਸਨ ਮੇਰੇ ਵਰਗਾ ਹੋਵੇਗਾ ਖੁੱਲ੍ਹੇ ਖਿਆਲਾਂ ਦਾ ਹੋਵੇਗਾ ਅਤੇ ਉਹ ਮੈਨੂੰ ਹਰੇਕ ਜਗ੍ਹਾ 'ਤੇ ਹਰ ਜਗ੍ਹਾ ਆਪਣੇ ਨਾਲ਼ ਰੱਖੇਗਾ ਅਤੇ ਬਹੁਤ ਈਜ਼ੀਲੀ ਉਹਨਾਂ ਚੀਜ਼ਾਂ ਨੂੰ ਮੇਰੇ ਨਾਲ਼ ਸਮਝੇਗਾ ਅਤੇ ਉਹਨਾਂ ਨੂੰ ਫੀਲ ਕਰੇਗਾ ਮਹਿਸੂਸ ਕਰੇਗਾ ਅਤੇ ਮੈਨੂੰ ਉਹ ਚੀਜ਼ ਬਹੁਤ ਜ਼ਿਆਦਾ ਵਧੀਆ ਲੱਗੇਗੀ ਅਤੇ ਜਦੋਂ ਮੈਂ ਉਹਦੇ ਨਾਲ਼ ਘੁੰਮਾਂਗੀ ਕਿਉਂਕਿ ਅਸੀਂ ਇੱਕੋ ਏਜ਼ ਦੇ ਪਰਸਨ ਹੋਵਾਂਗੇ ਉਹ ਮੈਨੂੰ ਸਮਝਦਾ ਹੋਵੇਗਾ ਮੈਂ ਉਹਨੂੰ ਸਮਝਦੀ ਹੋਵਾਂਗੀ ਅਤੇ ਆਹ ਚੀਜ਼ ਮੇਰੇ ਲਈ ਬਹੁਤ ਜ਼ਿਆਦਾ ਵਧੀਆ ਹੋਵੇਗੀ ਅਤੇ ਬਹੁਤ ਸਾਰੀਆਂ ਪਲੇਸਿਸ ਹੁੰਦੀਆਂ ਨੇ ਜਿਨ੍ਹਾਂ 'ਤੇ ਆਪਾਂ ਪੇਰੈਂਟਸ ਨਾਲ਼ ਨਹੀਂ ਜਾ ਸਕਦੇ ਜਾਂ ਫਿਰ ਇੱਦਾਂ ਕਹਿ ਲਓ ਕਿ ਪੇਰੈਂਟਸ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਅੱਜ ਦੇ ਟਾਈਮ 'ਚ ਮੋਡਰੇਟ ਨਹੀਂ ਹੁੰਦੇ ਤਾਂ ਮੈਂ ਉਹਦੇ ਨਾਲ਼ ਉਹਨਾਂ ਜਗ੍ਹਾ 'ਤੇ ਘੁੰਮਣਾ ਪਸੰਦ ਕਰਾਂਗੀ ਜਿੱਥੇ ਮੇਰੇ ਪੇਰੈਂਟਸ ਨਹੀਂ ਮੰਨਦੇ ਜਿਵੇਂ ਦੂਰ ਦੀਆਂ ਜਗ੍ਹਾ ਹੋ ਗਈਆਂ ਆਪਣੇ ਪੇਰੈਂਟਸ ਨਹੀਂ ਜਾਣ ਦਿੰਦੇ ਕੁੜੀਆਂ ਨੂੰ ਤਾਂ ਮੈਂ ਇਸ ਕਰਕੇ ਉਹਨਾਂ ਨਾਲ਼ ਉਸ ਜਗ੍ਹਾ 'ਤੇ ਬਹੁਤ ਜ਼ਿਆਦਾ ਘੁੰਮਣਾ ਅਤੇ ਇੰਜੋਏ ਕਰਨਾ ਚਾਹੂੰਗੀ